ਮੈਂ ਐਮਾਜ਼ੋਨ ਤੋਂ ਔਨਲਾਈਨ ਵੀ ਐੱਲ ਸੀ ਸੀ ਦੀ ਬਲੀਚ ਕਰੀਮ ਅਤੇ ਫੇਸ਼ੀਅਲ ਕਿੱਟ ਮੰਗਵਾਈ ਇਹਨੂੰ ਮੰਗਵਾਉਣ ਤੋਂ ਬਾਅਦ ਜਦੋਂ ਮੈਂ ਇਸ ਨੂੰ ਵਰਤੋਂ ਵਿੱਚ ਲਿਆਂਦਾ ਇਸ ਨੂੰ ਮੈਂ ਆਪਣੇ ਚਿਹਰੇ ਦੇ ਉੱਪਰ ਲਗਾਇਆ ਤਾਂ ਚਿਹਰੇ ਉੱਪਰ ਲਗਾਉਣ ਤੋਂ ਬਾਅਦ ਮੇਰੇ ਚਿਹਰੇ 'ਤੇ ਇਕਦਮ ਖ਼ਾਰਸ਼ ਹੋਣੀ ਸ਼ੁਰੂ ਹੋ ਗਈ ਅਤੇ ਉਸ ਤੋਂ ਬਾਅਦ ਮੇਰਾ ਚਿਹਰਾ ਪੂਰੀ ਤਰ੍ਹਾਂ ਲਾਲ ਹੋ ਗਿਆ ਇਸ ਨੂੰ ਵਰਤੋਂ ਵਿੱਚ ਲਿਆਉਣ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਵੀ ਇੱਦਾਂ ਦੇ ਪ੍ਰੋਡਕਟ ਕਦੀ ਵੀ ਵਰਤੋਂ ਵਿੱਚ ਨਾ ਲਿਆਂਦੇ ਜਾਣ ਇੱਕ ਤਾਂ ਇਹ ਪ੍ਰੋਡਕਟ ਪੈਸਾ ਖਰਾਬ ਕਰਦੇ ਨੇ ਮਹਿੰਗੇ ਹੁੰਦੇ ਨੇ ਇਸ ਦੀ ਜਗ੍ਹਾ ਜੇਕਰ ਅਸੀਂ ਨੋਰਮਲ ਆਪਣੇ ਕੁਦਰਤੀ ਚੀਜ਼ਾਂ ਨੂੰ ਵਰਤੋਂ ਵਿੱਚ ਲਿਆਈਏ ਤਾਂ ਇਸ ਦਾ ਬਹੁਤ ਸਾਰਾ ਫਾਇਦਾ ਹੋ ਸਕਦਾ ਹੈ